ਹਾਂਜੀ ਸਤਿ ਸ਼੍ਰੀ ਅਕਾਲ ਜੀ ਜੇਕਰ ਆਪਾਂ ਗੱਲ ਕਰੀਏ ਯੋਗਾ ਦੀ ਯੋਗਾ ਇੱਕ ਇਹੇ ਜੀ ਐਕਟੀਵਿਟੀ ਹੈ ਜੋ ਕਿ ਬਹੁਤ ਹੀ ਵਧੀਆ ਹਨ ਇਸ ਨੂੰ ਇਹ ਐਕਟੀਵਿਟੀ ਹਰ ਹਰ ਇੱਕ ਬੰਦਾ ਕਰ ਸਕਦਾ ਉਹ ਭਾਵੇਂ ਛੋਟਾ ਬੱਚਾ ਹੋਵੇ ਭਾਵੇਂ ਉਹ ਬਜ਼ੁਰਗ ਹੋਵੇ ਕਿਉਂਕਿ ਇਸ ਯੋਗੇ ਵਿੱਚ ਬਹੁਤ ਹੀ ਇਹੇ ਜਿਹੇ ਇਸਦੇ ਵਿੱਚ ਲੋਕਾਂ ਦਾ ਮਾਇੰਡ ਫਰੈੱਸ਼ ਹੁੰਦਾ ਹੈ ਅਤੇ ਇਹ ਜ਼ਿਆਦਾਤਰ ਲੋਕ ਇਸ ਨੂੰ ਸਵੇਰੇ ਮੋਰਨਿੰਗ ਵਿੱਚ ਜ਼ਿਆਦਾ ਕਰਦੇ ਹਨ ਅਤੇ ਇਹ ਇਸ ਦੇ ਨਾਲ ਆਪਣੇ ਸਰੀਰ ਵੀ ਫਿੱਟ ਰਹਿੰਦਾ ਹੈ ਅਤੇ ਲੋਕ ਯੋਗੇ ਕਰ ਨਾਲ ਉਹ ਬਿਮਾਰੀਆਂ ਤੋਂ ਵੀ ਬਚਦੇ ਹਨ